ਸਰਫਿੰਗ ਕਰਨ ਦੇ ਲਈ ਮੇਰੀ ਮਨਪਸੰਦ ਲਹਿਰ ਉੱਚੀ ਲਹਿਰਾਂ ਹਨ ਉੱਚੀ ਲਹਿਰਾਂ ਦੇ ਨਾਲ ਮੈਂ ਆਸਾਨੀ ਨਾਲ ਸਰਫ ਕਰ ਲੈਂਦੀ ਹਾਂ ਅਤੇ ਇਸ ਨਾਲ ਮੈਨੂੰ ਅਸਮਾਨ ਨੂੰ ਵੇਖਣ ਦਾ ਮੌਕਾ ਮਿਲਦਾ ਹੈ ਅਤੇ ਪਾਣੀ ਦੀ ਸੁੰਦਰਤਾ ਨੂੰ ਵੀ ਮੈਂ ਬੜੇ ਆਰਾਮ ਦੇ ਨਾਲ ਦੇਖ ਸਕਦੀ ਹਾਂ ਅਤੇ ਛੂਹ ਸਕਦੀ ਹਾਂ ਇਸ ਨਾਲ ਮੈਨੂੰ ਬਹੁਤ ਮਜ਼ਾ ਆਉਂਦਾ ਹੈ